ਹਾਂ ਕੁਝ ਦਿਨ ਅਜਿਹੇ ਵੀ ਹੁੰਦੇ ਹਨ ਜਿਸ ਦਿਨ ਮੇਰਾ ਮੂੜ ਨਹੀਂ ਹੁੰਦਾ ਡਰਾਇੰਗ ਕਰਨ ਦਾ ਜਿਸ ਦਿਨ ਮੇਰਾ ਮੂੜ ਡਰਾਇੰਗ ਕਰਨ ਦਾ ਨਹੀਂ ਹੁੰਦਾ ਉਸ ਦਿਨ ਮੈਂ ਡਰਾਇੰਗ ਨਹੀਂ ਬਣਾਉਣਾ ਚਾਹੁੰਦੀ ਪਰ ਜਦੋਂ ਮੈਂ ਕਿਸੇ ਖੁੱਲ੍ਹੇ ਅਤੇ ਸ਼ਾਂਤ ਮਾਹੌਲ ਵਿੱਚ ਬੈਠਦੀ ਹਾਂ ਤਾਂ ਆਪਣੇ ਆਸ ਪਾਸ ਦੇ ਮਾਹੌਲ ਨੂੰ ਦੇਖ ਕੇ ਮੇਰਾ ਮਨ ਕਰ ਆਉਂਦਾ ਹੈ ਡਰਾਇੰਗ ਕਰਨ ਦਾ ਆਪਣੇ ਆਸ ਪਾਸ ਦੇ ਖੇਡਦੇ ਬੱਚੇ ਅਤੇ ਪੰਛੀ ਉੱਡਦੇ ਪੰਛੀਆਂ ਨੂੰ ਦੇਖ ਕੇ ਮੈਨੂੰ ਪ੍ਰੇਰਨਾ ਮਿਲਦੀ ਹੈ ਵੀ ਮੈਂ ਮੈਂ ਇੱਕ ਵਧੀਆ ਡਰਾਇੰਗ ਤਿਆਰ ਕਰਾਂ ਅਤੇ ਆਪਣੀ ਡਰਾਇੰਗ ਨੂੰ ਵੇਚ ਕੇ ਪੈਸੇ ਕਮਾਵਾਂ ਜਦੋਂ ਮੈਂ ਖੁੱਲ੍ਹੇ ਮਾਹੌਲ ਵਿੱਚ ਬੈਠ ਕੇ ਆਪਣੀ ਡਰਾਇੰਗ ਬਨਾਉਂਦੀ ਹਾਂ ਤਾਂ ਮੈਂ ਉਹ ਮਾਹੌਲ 'ਤੇ ਇੱਕ ਡਰਾਇੰਗ ਤਿਆਰ ਕਰਦੀ ਹਾਂ ਜਿਸ ਨਾਲ ਇੱਕ ਪ੍ਰੇਰਨਾ ਦਾ ਇੱਕ ਮੈਨੂੰ ਪ੍ਰੇਰਨਾ ਦਾ ਇੱਕ ਮਤਲਬ ਸੂਚਨਾ ਮਿਲਦੀ ਹੈ ਹੈ ਉਸ ਡਰਾਇੰਗ ਨੂੰ ਮੈਂ ਇਸ ਤਰੀਕੇ ਨਾਲ ਬਣਾਉਂਦੀ ਹਾਂ ਕਿ ਜਿਸ ਨੂੰ ਮੈਂ ਉਹ ਡਰਾਇੰਗ ਵੇਚ ਸਕਾਂ ਉਹਨਾਂ ਦਾ ਵੀ ਮਨ ਖੁਸ਼ ਹੋਵੇ ਅਤੇ ਪੈਸੇ ਕਮਾ ਕੇ ਮੇਰਾ ਵੀ ਮਨ ਖੁਸ਼ ਹੋਵੇ ਇਹ ਉਸ ਡਰਾਇੰਗ ਤੋਂ ਇੱਕ ਬਣਾਉਣ ਦਾ ਇੱਕ ਹੋਰ ਉਦੇਸ਼ ਵੀ ਹੈ ਮੇਰਾ ਉਸ ਬਣੀ ਹੋਈ ਡਰਾਇੰਗ ਤੋਂ ਜੋ ਵੀ ਖਰੀਦ ਰਿਹਾ ਹੈ ਉਹਨਾਂ ਨੂੰ ਵੀ ਕੋਈ ਪ੍ਰੇਰਨਾ ਮਿਲੇ ਅਤੇ ਮੈਨੂੰ ਵੀ ਕੋਈ ਪ੍ਰੇਰਨਾ ਮਿਲੇ